ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸਰ ਤੁਹਾਨੂੰ ਕਿਹੜੇ ਨੰਬਰ ਦੀ ਕਾਰ ਚਾਹੀਦੀ ਜੀ ਦਿੱਲੀ ਨੰਬਰ ਚਾਹੀਦੀ ਹੈ ਮੋਹਾਲੀ ਨੰਬਰ ਚਾਹੀਦੀ ਹੈ ਜੀ ਦਿੱਲੀ ਨੰਬਰ ਸਰ ਆਪਣੇ ਕੋਲ ਇੱਥੇ ਦੋ ਗੱਡੀਆਂ ਖੜ੍ਹੀਆਂ ਜੀ ਇੱਕ ਆਈ ਟਵੈਂਟੀ ਖੜ੍ਹੀ ਹੈ ਜੀ ਇੱਕ ਬਰੈਜਾ ਖੜ੍ਹੀ ਹੈ ਅਤੇ ਆਪਣੇ ਕੋਲ ਕ ਹਾਂਜੀ ਸਰ ਆਈ ਟਵੈਂਟੀ ਦਾ ਰੇਟ ਹੈਗਾ ਜੀ ਇਸ ਟਾਈਮ ਆਪਣੇ ਕੋਲ ਹੈਗਾ ਜੀ ਤਿੰਨ ਲੱਖ ਤਿੰਨ ਲੱਖ ਦੇ ਕਰੀਬ ਹੈਗਾ ਜੀ ਅਤੇ ਗੱਡੀ ਸਾਫ ਹੈ ਗੱਡੀ ਫਸਟ ਓਨਰ ਹੈ ਜੀ ਔਰ ਚੱਲੀ ਵੀ ਵੀ ਥੋੜ੍ਹਾ ਟਾਈਮ ਹੈ ਜੀ ਦਸ ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਜੀ ਬਾਕੀ ਇੱਕ ਆਪਣੇ ਕੋਲ ਬਰੈਜਾ ਤੀ ਜੀ ਦਿੱਲੀ ਨੰਬਰ ਹਾਂਜੀ ਬਰੈਜਾ ਆਪਾਂ ਨੂੰ ਮਿਲ ਜੂਗੀ ਸਰ ਬ ਸਾਢੇ ਚਾਰ ਲੱਖ ਦੇ ਗੇੜ ਮ ਤੀ ਅਤੇ ਉਹ ਚੱਲੀ ਵੀ ਉਹ ਵੀ ਉਹ ਵੀ ਇੰਨਾਂ ਹੀ ਚੱਲੀ ਵੀ ਦਸ ਕੁ ਦਸ ਹਜ਼ਾਰ ਕਿਲੋਮੀਟਰ ਚੱਲੀ ਵੀ ਸਰ ਉਹ ਗਰੇਅ ਕਲਰ ਹੈ ਜੀ ਹਾਂਜੀ ਸਰ ਸ ਤੁਹਾਨੂੰ ਸਾਰੇ ਡਾਕੂਮੈਂਟ ਕਲੀਅਰ ਕਰਕੇ ਹੀ ਦੇਵਾਂਗੇ ਜੀ ਇੱਦਾਂ ਨਹੀਂ ਦੇਵਾਂਗੇ ਸਰ ਹਾਂਜੀ ਉਹ ਸਰ ਜਿਹੜੀ ਬਰੈਜਾ ਏ ਉਹ ਹੈਗੀ ਹੈ ਜੀ ਆਪਣਾ ਦੋ ਹਜ਼ਾਰ ਅਠ੍ਹਾਰਾਂ ਮੋਡਲ ਅਤੇ ਜਿਹੜੀ ਆਈ ਟਵੈਂਟੀ ਹੈ ਉਹ ਹੈਗੀ ਹੈ ਦੋ ਹਜ਼ਾਰ ਪੰਦਰ੍ਹਾਂ ਮੋਡਲ ਸਰ ਕੰਡੀਸ਼ਨ ਅਤੇ ਕੰਡੀਸ਼ਨ ਅਤੇ ਤੁਸੀਂ ਠੀਕ ਹੈ ਜੀ ਕੰਡੀਸ਼ਨ ਮੈਂ ਤੁਹਾਨੂੰ ਫੋਟੋਆਂ ਭੇਜ ਦਾਂਗਾ ਜੀ ਹਾਂਜੀ ਹਾਂਜੀ ਓਕੇ ਜੀ